ਪੰਜਾਬ ਦੇ ਰਵਾਈਤੀ ਕੱਪੜੇ ਅਤੇ ਫ਼ੈਸ਼ਨ ਸਟਾਇਲ ਵਿੱਚ ਕਾਫੀ ਅੰਤਰ ਆ ਚੁੱਕਾ ਹੈ ਪਹਿਲੇ ਸਮੇਂ ਨਾਲੋਂ ਅੱਜ ਦੇ ਲੋਕ ਕਾਫੀ ਮੋਡਰਨ ਹੋ ਚੁੱਕੇ ਹਨ ਉਹ ਵੀ ਵਿਦੇਸ਼ੀ ਕਲਚਰ ਨੂੰ ਅਪਣਾ ਕੇ ਖੁਸ਼ ਹਨ ਜਿੱਥੇ ਪੰਜਾਬ ਵਿੱਚ ਪਹਿਲੇ ਸਮਿਆਂ ਵਿੱਚ ਔਰਤਾਂ ਸਲਵਾਰ ਕਮੀਜ਼ ਘੱਗਰਾ ਅਤੇ ਮਰਦ ਧੋਤੀ ਕੁੜਤਾ ਅਤੇ ਪੱਗਾਂ ਬੰਨ੍ਹਦੇ ਸਨ ਅੱਜ ਦੇ ਸਮੇਂ ਵਿੱਚ ਕੁੜੀਆਂ ਦੇ ਫ਼ੈਸ਼ਨ ਵਿੱਚ ਕੁਝ ਤਬਦੀਲੀ ਆ ਗਈ ਹੈ ਅੱਜ ਵੀ ਇੱਥੇ ਸਲਵਾਰ ਕਮੀਜ਼ ਦੇ ਨਾਲ ਨਾਲ ਕੁੜੀਆਂ ਜੀਨ ਟੀ ਸ਼ਰਟ ਸਾੜੀਆਂ ਲਹਿੰਗੇ ਸਕਲਟਾਂ ਪਲਾਜ਼ੋ ਪਾ ਕੇ ਖੁਸ਼ ਹੁੰਦੀਆਂ ਹਨ ਮਰਦਾਂ ਦੇ ਫ਼ੈਸ਼ਨ ਵਿੱਚ ਵੀ ਕਾਫੀ ਤਬਦੀਲੀ ਆ ਗਈ ਹੈ ਹੁਣ ਪੰਜਾਬ ਦੇ ਮਰਦ ਧੋਤੀ ਕੁੜਤਾ ਨਹੀਂ ਕੁੜਤਾ ਪਜਾਮਾ ਜੀਨ ਪੈਂਟਾਂ ਸ਼ਰਟਾਂ ਅਤੇ ਟੀ ਸ਼ਰਟਾਂ ਪਾ ਕੇ ਖੁਸ਼ ਹਨ ਵੱਖ ਵੱਖ ਖੇਤਰਾਂ ਅਤੇ ਭਾਈਚਾਰਿਆਂ ਵਿੱਚ ਵੀ ਪਹਿਰਾਵੇ ਦਾ ਬਹੁਤ ਅੰਤਰ ਹੈ ਜਿਵੇਂ ਜੰਮੂ ਕਸ਼ਮੀਰ ਵਿੱਚ ਔਰਤਾਂ ਫੈਹਰਨ ਸਲਵਾਰ ਪਜਾਮੀ ਅਤੇ ਮਰਦ ਫੈਹਰਨ ਅਤੇ ਪਠਾਨੀ ਪਾਉਂਦੇ ਹਨ ਕੇਰਲਾ ਵਿੱਚ ਔਰਤਾਂ ਸਿਲਕੀ ਸਾੜੀ ਅਤੇ ਮਰਦ ਸ਼ਰਟਾਂ ਅਤੇ ਲੂੰਗੀ ਪਾਉਂਦੇ ਹਨ ਰਾਜਸਥਾਨ ਵਿੱਚ ਮਰਦ ਪਜਾਮਾ ਧੋਤੀ ਕੁੜਤਾ ਅਤੇ ਸਾਫਾ ਬੰਨ੍ਹਦੇ ਹਨ ਅਤੇ ਔਰਤਾਂ ਘੱਗਰਾ ਅਤੇ ਚੋਲੀ ਪਾਉਂਦੀਆਂ ਹਨ ਇਸੇ ਤਰ੍ਹਾਂ ਹਰ ਖੇਤਰ ਦਾ ਪਹਿਰਾਵਾ ਵੱਖੋ ਵੱਖਰਾ ਹੈ ਹਰ ਖੇਤਰ ਦੇ ਭਾਈਚਾਰੇ ਵਿੱਚ ਵੀ ਫਰਕ ਹੈ ਉਨ੍ਹਾਂ ਦੇ ਰੀਤੀ ਰਿਵਾਜ਼ਾਂ ਵਿੱਚ ਵੀ ਕਾਫੀ ਅੰਤਰ ਹੈ